ਮੇਰਾ ਨਾਮ ਮੋਨਿਕਾ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਮੇਰੀ ਦਾਦੀ ਜੀ ਨੇ ਮੈਨੂੰ ਸਬਜ਼ੀ ਬਣਾਉਣੀ ਸਿਖਾਈ ਅਤੇ ਮੈਂ ਜ਼ਿਆਦਾਤਰ ਮਿਕਸ ਸਬਜ਼ੀ ਹੀ ਬਣਾਉਣਾ ਪਸੰਦ ਕਰਦੀ ਹੈ ਅਤੇ ਮੇਰੇ ਸਾਰੇ ਘਰਦਿਆਂ ਨੂੰ ਮਿਕਸ ਸਬਜ਼ੀ ਹੀ ਪਸੰਦ ਹੈ ਮੈਂ ਮਿਕਸ ਸਬਜ਼ੀ ਵਿੱਚ ਗਾਜਰਾਂ ਆਲੂ ਮਟਰ ਅਤੇ ਹੋਰ ਵੀ ਕੁਝ ਚਾਹੇ ਗੋਭੀ ਲੈ ਲਓ ਉਹ ਵੀ ਪਾਉਂਦੀ ਹੈ ਫਿਰ ਮੈਂ ਪਹਿਲਾਂ ਤੇਲ ਗਰਮ ਕਰਦੀ ਹੈ ਉਸਨੂੰ ਚੰਗੀ ਤਰ੍ਹਾਂ ਗਰਮ ਕਰਕੇ ਉਸ ਵਿੱਚ ਜੀਰਾ ਪਾਉਂਦੀ ਹੈ ਜੀਰਾ ਪਾ ਕੇ ਫਿਰ ਮੈਂ ਪਿਆਜ ਟਮਾਟਰ ਜੋ ਵੀ ਮਸਾਲੇ ਵਗੈਰਾ ਏ ਉਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਫਿਰ ਉਸ ਵਿੱਚ ਸਬਜ਼ੀ ਪਾਉਂਦੀ ਹੈ ਸਬਜ਼ੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹਿਲਾ ਕੇ ਉਸ ਵਿੱਚ ਉਸਨੂੰ ਢੱਕ ਦਿੰਦੀ ਹੈ ਅਤੇ ਮੇਰੇ ਹੱਥਾਂ ਦੀ ਸਬਜ਼ੀ ਜਦੋਂ ਬਣਦੀ ਹੈ ਤਾਂ ਸਾਰਿਆਂ ਨੂੰ ਬਹੁਤ ਹੀ ਸਵਾਦ ਲੱਗਦੀ ਹੈ ਜ਼ਿਆਦਾਤਰ ਮੇਰੀ ਦਾਦੀ ਜੀ ਨੇ ਮੈਨੂੰ ਇਹ ਸਬਜ਼ੀ ਸਿਖਾਈ ਉਹਨਾਂ ਨੂੰ ਤਾਂ ਸਾਰਿਆਂ ਨਾਲੋਂ ਜ਼ਿਆਦਾ ਸਵਾਦ ਲੱਗਦੀ ਹੈ ਅਤੇ ਉਨ੍ਹਾਂ ਨੇ ਜਦੋਂ ਮੈਂ ਪਹਿਲੀ ਵਾਰ ਸਬਜ਼ੀ ਬਣਾਈ ਅਤੇ ਉਹਨਾਂ ਨੂੰ ਬਹੁਤ ਹੀ ਪਸੰਦ ਆਈ ਅਤੇ ਉਹਨਾਂ ਨੇ ਮੇਰੀ ਸਾਰਿਆਂ ਨਾਲੋਂ ਜ਼ਿਆਦਾ ਤਾਰੀਫ ਕੀਤੀ